ਮੈਨੂੰ ਸਕੂਲ ਟਾਈਮ ਤੋਂ ਹੀ ਬੁਣਾਈ ਅਤੇ ਸਿਲਾਈ ਦਾ ਸ਼ੌਂਕ ਸੀ ਅਤੇ ਬਾਰ੍ਹਵੀਂ ਕਰਨ ਤੋਂ ਬਾਅਦ ਮੈਂ ਫੈਸ਼ਨ ਡਿਜਾਇਨਿੰਗ ਦੇ ਡਿਪਲੋਮੇ ਵਿੱਚ ਐਡਮਿਸ਼ਨ ਲਈ ਅਤੇ ਜਦੋਂ ਮੈਂ ਐਡਮਿਸ਼ਨ ਲਈ ਤਾਂ ਮੈਂ ਨਵੇਂ ਨਵੇਂ ਡਿਜ਼ਾਇਨਾਂ ਦੇ ਸੂਟ ਡਰੈਸਾਂ ਬਣਾਉਣੀਆਂ ਸਿੱਖੀਆਂ ਅਤੇ ਟਰੈਂਡ ਦੇ ਹਿਸਾਬ ਦੇ ਨਾਲ ਨਵੇਂ ਨਵੇਂ ਸੂਟ ਸਿਉਣ ਅਤੇ ਪਾਉਣ ਦਾ ਸ਼ੌਂਕ ਮੇਰੇ ਅੰਦਰ ਪੈਦਾ ਹੋਇਆ ਅਤੇ ਉਦੋਂ ਤੋਂ ਹੀ ਮੈਂ ਪੂਰਾ ਮਨ ਲਗਾ ਕੇ ਪੂਰੀ ਦਿਲਚਸਪੀ ਦੇ ਨਾਲ ਬੁਣਾਈ ਅਤੇ ਸਿਲਾਈ ਕਰਨੀ ਸ਼ੁਰੂ ਕੀਤੀ ਮੈਨੂੰ ਲਗਭਗ ਪੰਜ ਸਾਲ ਹੋ ਚੁੱਕੇ ਹਨ ਇਸ ਕੰਮ ਨੂੰ ਕਰਦੇ ਹੋਏ ਅਤੇ ਮੇਰੇ ਤੋਂ ਇਲਾਵਾ ਮੇਰੇ ਮਾਤਾ ਅਤੇ ਭੈਣ ਨੂੰ ਵੀ ਬੁਣਾਈ ਅਤੇ ਸਿਲਾਈ ਦਾ ਬਹੁਤ ਸ਼ੌਂਕ ਸੀ ਮੇਰੇ ਨਾਲ ਨਾਲ ਮੇਰੀ ਭੈਣ ਵੀ ਸਿਲਾਈ ਅਤੇ ਬੁਣਾਈ ਕਰਦੇ ਹਨ ਅਤੇ ਉਹ ਆਪਣੇ ਵਿਹਲੇ ਟਾਇਮ ਦੇ ਵਿੱਚ ਸਿਲਾਈ ਅਤੇ ਬੁਣਾਈ ਕਰਕੇ ਆਪਣੇ ਲਈ ਪੈਸੇ ਕਮਾਉਂਦੇ ਹਨ ਅਤੇ ਇਸ ਨੂੰ ਕਰਦੇ ਰਹਿਣ ਦੀ ਸਾਡੀ ਇਹੋ ਪ੍ਰੇਰਨਾ ਹੈ ਕਿ ਅਸੀਂ ਇੱਕ ਕੁਸ਼ਲ ਸਿਲਾਈਕਾਰ ਬਣ ਸਕੀਏ ਅਤੇ ਲੋਕਾਂ ਨੂੰ ਨਵੇਂ ਨਵੇਂ ਡਿਜ਼ਾਇਨਾਂ ਆਪਣੇ ਕਲਾ ਅਤੇ ਹੁਨਰ ਦੇ ਅਨੁਸਾਰ ਸੂਟ ਅਤੇ ਕੱਪੜੇ ਸਿਲਾਈ ਅਤੇ ਬੁਣਾਈ ਕਰਕੇ ਮੁਹੱਈਆ ਕਰਵਾ ਸਕੀਏ ਅਤੇ ਅੱਛੀ ਕਮਾਈ ਕਰ ਸਕੀਏ